ਪੰਜਾਬ ਦੀ ਆਰਥਿਕਤਾ ਦੇ ਵਿੱਚ ਅਤੇ ਸਮਾਜ ਦੇ ਵਿੱਚ ਬਦਲਾਅ ਦੇ ਜੇ ਅਸੀਂ ਕਾਰਨਾਂ ਦੀ ਜਾਂਚ ਕਰੀਏ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਜਦੋਂ ਬ੍ਰਿਟਿਸ਼ ਹਕੂਮਤ ਨੇ ਆਪਣੇ ਫੌਜੀ ਬਣਾ ਕੇ ਵੱਖ ਵੱਖ ਦੇਸ਼ਾਂ ਦੇ ਵਿੱਚ ਵਲਡ ਵਾਰ ਪਹਿਲੀ ਅਤੇ ਵਿਸ਼ਵ ਜੰਗ ਦੂਜੀ ਦੇ ਵਿੱਚ ਵਰਤਿਆ ਤਾਂ ਉਦੋਂ ਬਹੁਤ ਸਾਰੇ ਲੋਕ ਜਦੋਂ ਬਾਹਰ ਗਏ ਅਤੇ ਉੱਥੋਂ ਦੇ ਲੋਕਾਂ ਦਾ ਰਹਿਣ ਸਹਿਣ ਵੇਖਿਆ ਅਤੇ ਉਹਨਾਂ ਨੇ ਆਣ ਕੇ ਆਪਣੀ ਫਿਰ ਇੱਧਰ ਜਦੋਂ ਰਿਟਾਇਰ ਹੋ ਕੇ ਪਹੁੰਚੇ ਅਤੇ ਉਹਨਾਂ ਨੇ ਪੰਜਾਬ ਦੇ ਵਿੱਚ ਆਰਥਿਕਤਾ ਦੇ ਉਹੋ ਜਿਹੇ ਮਾਪਦੰਡਾਂ ਨੂੰ ਅਪਣਾਇਆ ਅਤੇ ਹੌਲੀ ਹੌਲੀ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਪੰਜਾਬ ਨੇ ਹਰੀ ਕ੍ਰਾਂਤੀ ਦੇ ਵਿੱਚ ਮੋਹਰੀ ਬਣਿਆ ਜਿਸ ਦੇ ਨਾਲ ਪੰਜਾਬ ਦੇ ਵਿੱਚ ਖੇਤੀ ਨੂੰ ਕਰਨੀਆਂ ਨਵੀਆਂ ਤਕਨੀਕਾਂ ਆਈਆਂ ਖੇਤੀ ਦੇ ਬੀਜਾਂ ਦੇ ਉੱਪਰ ਨਵੀਂ ਤਰ੍ਹਾਂ ਦੀ ਖੋਜ ਹੋਈ ਇੱਥੇ ਪਸ਼ੂ ਪਾਲਣ ਹੋਰ ਚੀਜ਼ਾਂ ਦੇ ਵਿੱਚ ਵਾਧਾ ਹੋਇਆ ਅਤੇ ਉਸ ਨੇ ਪੰਜਾਬ ਦੇ ਲੋਕਾਂ ਨੂੰ ਮਿਹਨਤ ਅਤੇ ਹੋਰ ਚੀਜ਼ਾਂ ਵਿੱਚ ਤਕੜੇ ਕੀਤਾ ਅਤੇ ਉਹਨਾਂ ਨੂੰ ਸਰਕਾਰ ਵੱਲੋਂ ਵੀ ਕਈ ਇਸ ਤਰ੍ਹਾਂ ਦੀਆਂ ਸਹੂਲਤਾਂ ਵੀ ਦਿੱਤੀਆਂ ਗਈਆਂ ਜਿਹਦੇ ਨਾਲ ਪੰਜਾਬ ਖੇਤੀ ਦੇ ਵਿੱਚ ਅੱਗੇ ਵੱਧ ਸਕਦਾ ਸੀ ਅਤੇ ਉਸ ਨੇ ਪੰਜਾਬ ਦੀ ਵਾਧੇ ਵਿੱਚ ਬਹੁਤ ਵੱਡੀ ਉਸਨੂੰ ਅੱਗੇ ਪਲਾਂਘ ਪੁੱਟਣ ਵਾਸਤੇ ਮਦਦ ਕੀਤੀ